ਅਸੀਂ ਪੇਂਡੂ ਖੇਤਰ ਵਿੱਚ ਰਹਿੰਦੇ ਹਾਂ ਅਤੇ ਸਾਡੇ ਪੇਂਡੂ ਖੇਤਰ ਦਾ ਮੁੱਖ ਕਿਰਤ ਕਰਨ ਦਾ ਸਾਧਨ ਖੇਤੀਬਾੜੀ ਹੈ ਜ਼ਿਆਦਾਤਰ ਲੋਕ ਅੱਸੀ ਪ੍ਰਸੈਂਟ ਲੋਕ ਨੇ ਜਿਹੜੇ ਉਹ ਖੇਤੀਬਾੜੀ ਕਰਦੇ ਹਨ ਜੋ ਕਿ ਉਹਨਾਂ ਦਾ ਖਾਨਦਾਨੀ ਕਿੱਤਾ ਹੈ ਖੇਤੀਬਾੜੀ ਇੱਕ ਸਭ ਤੋਂ ਇਮਾਨਦਾਰੀ ਵਾਲਾ ਕਿੱਤਾ ਮੰਨਿਆਂ ਜਾਂਦਾ ਹੈ ਅਤੇ ਪਿੰਡਾਂ ਦੇ ਲੋਕਾਂ ਦਾ ਜੀਵਨ ਕਿਰਸਾਨੀ 'ਤੇ ਨਿਰਭਰ ਹੈ ਉਹ ਆਪਣੀ ਫਸਲ ਉਗਾਉਂਦੇ ਹਨ ਅਤੇ ਉਸਨੂੰ ਹੀ ਵਰਤਦੇ ਹਨ ਜੋ ਫਸਲ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਉਸਨੂੰ ਉਹ ਵੇਚ ਦਿੰਦੇ ਹਨ ਅਤੇ ਉਸਦੇ ਨਾਲ ਆਪਣੀ ਆਈ ਚਲਾਈ ਚਲਾਉਂਦੇ ਹਨ ਪਰ ਖੇਤੀਬਾੜੀ ਦੇ ਵਿੱਚ ਕੁਦਰਤ ਕਾਫੀ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਜਿਵੇਂ ਕਿ ਵਰਖਾ ਅਤੇ ਗੜੇ ਪੈ ਜਾਂਦੇ ਹਨ ਜਦੋਂ ਫਸਲ ਪੱਕਣ 'ਤੇ ਆਈ ਹੁੰਦੀ ਹੈ ਜਿਸ ਨਾਲ ਕਾਫੀ ਜ਼ਿਆਦਾ ਨੁਕਸਾਨ ਇੱਕ ਕਿਸਾਨ ਨੂੰ ਝੱਲਣਾ ਪੈਂਦਾ ਹੈ ਅਤੇ ਸਰਕਾਰਾਂ ਸਰਕਾਰ ਦੁਆਰਾ ਕਿਸਾਨਾਂ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਜਾਂਦੀ ਭਾਵੇਂ ਕਿ ਇਸ ਬਾਰੇ ਉਹਨਾਂ ਦੁਆਰਾ ਬਹੁਤ ਜ਼ਿਆਦਾ ਖਬਰਾਂ ਫੈਲਾਈਆਂ ਜਾਂਦੀਆਂ ਹਨ ਸਭ ਤੋਂ ਵੱਡੀ ਚੁਣੌਤੀ ਖੇਤੀਬਾੜੀ ਬਾਰੇ ਕਿਸਾਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਜੋ ਫਸਲਾਂ ਦੇ ਰੇਟ ਨੇ ਉਹ ਵੀ ਸਹੀ ਨਹੀਂ ਮਿਲਦੇ ਬਾਕੀ ਜੇ ਆਪਾਂ ਮੰਨੀਏ ਵੀਹ ਪ੍ਰਸੈਂਟ ਲੋਕ ਜੋ ਕਿ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ ਉਹਨਾਂ ਟੈਕਨੋਲਜੀ ਦੇ ਖੇਤਰ ਵਿੱਚ ਵੀ ਜਾਂਦੇ ਹਨ ਜਿੱਦਾਂ ਕਿ ਬੱਚੇ ਅੱਜ ਕੱਲ੍ਹ ਜ਼ਿਆਦਾ ਪੜ੍ਹੇ ਲਿਖੇ ਹਨ ਅਤੇ ਉਹ ਟੈਕਨੋਲਜੀ ਦੇ ਖੇਤਰ ਵਿੱਚ ਜਾਣਾ ਪਸੰਦ ਕਰਦੇ ਹਨ ਅਤੇ ਉਹ ਆਪਣਾ ਕਿੱਤਾ ਖੇਤੀਬਾੜੀ ਨੂੰ ਛੱਡ ਟੈਕਨੋਲਜੀ ਵਾਲੇ ਖੇਤਰ ਵਿੱਚ ਜਾਣਾ ਪਸੰਦ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀਬਾੜੀ ਵਿੱਚ ਘੱਟ ਫਾਇਦਾ ਹੁੰਦਾ ਹੈ ਜੋ ਕਿ ਉਹ ਕਿਸੇ ਹੋਰ ਖੇਤਰ ਵਿੱਚ ਆਪਣਾ ਭਵਿੱਖ ਸੰਵਾਰ ਸਕਣ ਕਿਉਂਕਿ ਖੇਤੀਬਾੜੀ ਤਾਂ ਉਹਨਾਂ ਦਾ ਇੱਕ ਪੁਰਾਤਨ ਅਤੇ ਜੱਦੀ ਕਿੱਤਾ ਹੈ ਉਹ ਉਹਨਾਂ ਦੇ ਮਾਂ ਬਾਪ ਕਰ ਰਹੇ ਹਨ ਪਰ ਉਹਨਾਂ ਨੂੰ ਉਨਾਂ ਮੁੱਲ ਨਹੀਂ ਮਿਲਦਾ ਜਿੰਨੀ ਉਹ ਮਿਹਨਤ ਕਰਦੇ ਹਨ